ਆਨਲਾਈਨ ਸਕੂਲਿੰਗ ਬਾਰੇ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਪਹਿਲਾਂ ਦੇ ਜਮਾਨੇ ਵਿੱਚ ਇਹ ਸਭ ਕੁਛ ਨਹੀਂ ਹੁੰਦਾ ਸੀ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਸੀ ਕਿ ਆਨਲਾਈਨ ਸਕੂਲਿੰਗ ਵਰਗੀ ਕੋਈ ਚੀਜ਼ ਵੀ ਹੋ ਸਕਦੀ ਹੈ ਪਰ ਇਸਦੇ ਜਿਹੜਾ ਪ੍ਰਭਾਵ ਜ਼ਿਆਦਾ ਪਿਆ ਉਹ ਪਿਆ ਕਰੋਨਾ ਦੇ ਟਾਈਮ ਵਿੱਚ ਦੋ ਹਜ਼ਾਰ ਵੀਹ ਦੋ ਹਜ਼ਾਰ ਉੱਨੀ ਜਾਂ ਦੋ ਹਜ਼ਾਰ ਇੱਕੀ ਇਸ ਟਾਈਮ ਵਿੱਚ ਜਿਹੜੇ ਸਕੂਲਜ਼ ਨੇ ਉਹਨਾਂ ਨੇ ਆਨਲਾਈਨ ਕਲਾਸਾਂ ਲੈਣੀਆਂ ਸ਼ੁਰੂ ਕਰਤੀਆਂ ਬੱਚਿਆਂ ਦੀਆਂ ਕਾਲਜਾਂ ਨੇ ਆਨਲਾਈਨ ਕਲਾਸਾਂ ਲੈਣੀਆਂ ਸ਼ੁਰੂ ਕਰਤੀਆਂ ਯੂਨੀਵਰਸਿਟੀਆਂ ਨੇ ਆਨਲਾਈਨ ਕਲਾਸਾਂ ਸ਼ੁਰੂ ਲੈ ਕਰ ਕਰਤੀਆਂ ਉਹਨਾਂ ਦੀਆਂ ਕਲਾਸਾਂ ਲੈਣੀਆ ਕਿਤੇ ਨਾ ਕਿਤੇ ਇਹਨੇ ਵਿੱਦਿਆ ਪ੍ਰਣਾਲੀ ਨੂੰ ਤੁਰਦਾ ਰੱਖਿਆ ਪੜ੍ਹਾਈ ਚਲਦੀ ਰਹੀ ਪਰ ਉਹ ਚੀਜ਼ ਕਿਤੇ ਨਾ ਕਿਤੇ ਵਿਗੜ ਗਈ ਕਿ ਜੋ ਚੀਜ਼ ਬੱਚੇ ਫਿਜੀਕਲ ਕਲਾਸਿਸ 'ਚੋਂ ਪੜ੍ਹ ਸਕਦੇ ਨੇ ਉਹ ਕਦੇ ਵੀ ਜਿਹੜੀ ਆਨਲਾਈਨ ਕਲਾਸ ਹੈ ਇਹਦੇ ਵਿੱਚ ਨਹੀਂ ਪੜ੍ਹ ਸਕਦੇ ਔਨਲਾਈਨ ਕਲਾਸ ਦੇ ਬੜੇ ਜ਼ਿਆਦਾ ਉਹਦੇ ਪਰਾਨਜ਼ ਜਿਹਨੂੰ ਆਪਾਂ ਕਹਿ ਦੇਈਏ ਹੋਏ ਕਿ ਉਸ ਚੀਜ਼ ਨੇ ਬੰਦਿਆਂ ਨੂੰ ਪੜ੍ਹਨਾ ਭੁਲਾਤਾ ਕਈ ਬੱਚੇ ਜਿਹੜੇ ਕਿ ਮੋਸਟ ਇੰਟੈਲੀਜਟ ਸੀਗੇ ਕਲਾਸਾਂ ਦੇ ਉਹ ਕਰੋਨਾ ਤੋਂ ਬਾਅਦ ਦੀਆਂ ਕਲਾਸਾਂ ਵਿੱਚ ਫੇਲ ਹੋ ਕੇ ਡਿੱਗੇ ਇਸ ਕਰਕੇ ਕਿਤੇ ਨਾ ਕਿਤੇ ਇਹਨੇ ਸਾਡੇ ਯੂਥ ਵਿੱਚ ਬਹੁਤ ਵੱਡਾ ਨੁਕਸਾਨ ਕੀਤਾ ਅਸੀਂ ਕਹਿ ਸਕਦੇ ਹਾਂ ਅਸੀਂ ਆਨਲਾਈਨ ਕਲਾਸ ਬਾਰੇ ਇਹ ਕਹਿ ਸਕਦੇ ਹਾਂ ਕਿ ਬਸ ਇਹਨੇ ਸਾਡੀ ਪ੍ਰਣਾਲੀ ਨੂੰ ਤੁਰਦਾ ਰੱਖਿਆ ਪਰ ਇਹਨੇ ਉਹਦੇ ਵਿੱਚ ਕੋਈ ਸੁਧਾਰ ਨਹੀਂ ਕੀਤਾ ਅੱਜ ਕੱਲ੍ਹ ਇਹ ਬੜੇ ਜਾਣਿਆਂ ਦਾ ਰੋਜ਼ਗਾਰ ਵੀ ਬਣ ਗਿਆ ਹੈ ਲੋਕਾਂ ਨੇ ਆਪਣੀ ਟਿਊਸ਼ਨ ਕਲਾਸਿਜ ਸਟਾਰਟ ਕਰਤੀਆਂ ਯੂਟੀਊਬ 'ਤੇ ਜਿਹੜੀ ਕਿ ਆਨਲਾਈਨ ਕਲਾਸਿਜ ਲੈਂਦੇ ਆ ਜਾਂ ਆਨਲਾਈਨ ਕੋਚਿੰਗ ਦਿੰਦੇ ਆ ਕਿਤੇ ਨਾ ਕਿਤੇ ਇਹ ਬੱਚਿਆਂ ਲਈ ਫਾਇਦੇਮੰਦ ਹੈ ਫਾਇਦੇਮੰਦ ਹੈ ਇਹ ਹੈ ਕਿ ਐਕਸਟਰਾ ਸਟਡੀ ਹੈ ਪਰ ਜੋ ਫਿਜੀਕਲ ਕਲਾਸਿਸ ਲੱਗ ਲੱਗਦੀਆਂ ਹੈ ਜੋ ਟੀਚਰ ਦਾ ਡਰ ਹੁੰਦਾ ਹੈ ਉਹ ਡਰ ਹੁੰਦਾ ਇਸ ਕਰਕੇ ਸਾਨੂੰ ਕਿਤੇ ਨਾ ਕਿਤੇ ਇਹ ਕੋਚਿੰਗ ਆਨਲਾਈਨ ਕੋਚਿੰਗ ਨੂੰ ਛੱਡ ਕੇ ਫਿਜੀਕਲ ਕੋਚਿੰਗ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਗੌਰਮੈਂਟ ਨੂੰ ਵੀ ਫਿਜੀਕਲ ਕੋਚਿੰਗ ਬਾਰੇ ਜ਼ਿਆਦਾ ਧਿਆਨ ਦੇਣਾ ਚਾਹੀਦਾ